ਹਾਂਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਸਿੱਧੂ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਮੈਨੂੰ ਤੁਹਾਡਾ ਨੰਬਰ ਮੇਰੇ ਇੱਕ ਨੋਨ ਨੇ ਦਿੱਤਾ ਸੀ ਅਤੇ ਸਾਡੇ ਬੱਚੇ ਇੱਥੇ ਚੰਡੀਗੜ੍ਹ ਪੜ੍ਹਦੇ ਸੀਗੇ ਜਿਹੜੇ ਸੈਕਟਰ ਚੌਂਹਠ ਵਿੱਚ ਰਹਿੰਦੇ ਨੇ ਅਤੇ ਉੱਥੋਂ ਉਹਨਾਂ ਨੇ ਆਪਣਾ ਸਮਾਨ ਵਗੈਰਾ ਵਾਪਸ ਲੈ ਕੇ ਬਠਿੰਡਾ ਆਉਣਾ ਸੀਗਾ ਜੀ ਅਤੇ ਬਠਿੰਡਾ ਅਸੀਂ ਬੱਸ ਸਟੈਂਡ ਕੋਲ ਹੀ ਰਹਿੰਦੇ ਹਾਂ ਅਤੇ ਉਹ ਆਪ ਵੀ ਚਾਰ ਜਣੇ ਹੈਗੇ ਨੇ ਅਤੇ ਉਹਨਾਂ ਕੋਲ ਸਮਾਨ ਵੀ ਕਾਫੀ ਹੈਗਾ ਅਤੇ ਉਹਨਾਂ ਵਾਸਤੇ ਕਿਹੜੀ ਗੱਡੀ ਸਹੀ ਰਹੇਗੀ ਤੁਸੀਂ ਦੇਖ ਲਿਓ ਅਤੇ ਬਾਕੀ ਕਿਲੋਮੀਟਰ ਤੱਕ ਇਹ ਹਿਸਾਬ ਕਿਤਾਬ ਹੈ ਤੁਹਾਡਾ ਕੀ ਰੇਟ ਚੱਲ ਰਿਹਾ ਉਹ ਮੈਨੂੰ ਦੱਸ ਦਿਓ ਤਾਂ ਕਿ ਅਸੀਂ ਤੁਹਾਨੂੰ ਪੇਮੈਂਟ ਕਰ ਸਕੀਏ ਅਤੇ ਟਾਈਮ ਵਗੈਰਾ ਵੀ ਅਸੀਂ ਤੁਹਾਨੂੰ ਦੱਸ ਦਈਏ ਵੀ ਐਨੇ ਵਜੇ ਸਾਨੂੰ ਗੱਡੀ ਚਾਹੀਦੀ ਹੈਗੀ